ਪੰਜਾਬੀ ਲੋਕ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਇਹਨਾਂ ਵਿੱਚ ਇੱਕ ਤੁਸੀਂ ਲੋਹੜੀ ਅਤੇ ਦੂਜੀ ਵਿਸਾਖੀ ਦਾ ਤਿਉਹਾਰ ਹੈ ਜਿਸ ਨੂੰ ਪੰਜਾਬ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਤੇਰ੍ਹਾਂ ਅਪ੍ਰੈਲ ਸੋਲ੍ਹਾਂ ਸੌ ਨੜਿਨਵੇਂ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਇਹ ਵਿਸਾਖੀ ਦਾ ਤਿਉਹਾਰ ਬੜੇ ਚਾਅ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਅਤੇ ਪੰਜਾਬ ਨੇ ਆਪਣੇ ਸੱਭਿਆਚਾਰਕ ਵਿਰਾਸਤ ਵਿੱਚ ਭੰਗੜੇ ਨੂੰ ਵੀ ਬੜੀ ਧੂਮਧਾਮ ਨਾਲ ਸਾਂਭ ਕੇ ਰੱਖਿਆ ਹੋਇਆ ਪੰਜਾਬੀ ਮੁੰਡੇ ਭੰਗੜਾ ਪਾਉਣ 'ਚ ਨੂੰ ਬੜਾ ਪਸੰਦ ਕਰਦੇ ਨੇ ਅਤੇ ਵਿਆਹ ਸ਼ਾਦੀਆਂ 'ਚ ਇਹ ਭੰਗੜਾ ਚਲਦਾ ਹੈ ਅਤੇ ਕੁੜੀਆਂ ਜਿਹੜੀਆਂ ਹੈ ਉਹ ਗਿੱਧਾ ਪਾਉਂਦੀਆਂ ਨੇ ਅਤੇ ਫੁਲਕਾਰੀ ਸ਼ਰਾਰਾ ਵਗੈਰਾ ਲੈਂਦੀਆਂ ਨੇ ਇਹ ਪ੍ਰਥਾ ਪੰਜਾਬ ਵਿੱਚ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਪੰਜਾਬ ਨੇ ਆਪਣੀ ਵਿਰਾਸਤ ਵਿੱਚ ਗੁਰੂਆਂ ਪੀਰਾਂ ਨੂੰ ਕਾਫੀ ਯਾਦਗਾਰ ਬਣਾਇਆ ਹੋਇਆ ਹੈ ਇੱਥੇ ਇਹਨਾਂ ਨੇ ਗੁਰਦੁਆਰੇ ਵਗੈਰਾ ਉਹਨਾਂ ਦੀ ਯਾਦ ਵਿੱਚ ਖੋਲੇ ਹੋਏ ਹਨ ਜੋ ਕਿ ਪੂਰੇ ਵਰਲਡ 'ਚ ਫੇਮਸ ਨੇ